ਹਾਂਜੀ ਮੈਂ ਜੂਮ ਐਪ ਦੁਆਰਾ ਇੱਕ ਮੀਟਿੰਗ 'ਚ ਸ਼ਾਮਿਲ ਹੋਈ ਸੀਗੀ ਜਿਹੜੀ ਕਿ ਹਿੰਦੀ ਵਿਸ਼ੇ ਨਾਲ ਸੰਬੰਧਿਤ ਸੀ ਅਤੇ ਉਸ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੀ ਪਦਤੀ ਬਾਰੇ ਦੱਸਿਆ ਸੀਗਾ ਹਾਂ ਉਹ ਕੁਛ ਹੱਦ ਤੱਕ ਮੈਨੂੰ ਉਹ ਵਧੀਆ ਲੱਗੀ ਪਰ ਇੱਕ ਗੱਲ ਨਾ ਪਸੰਦ ਸੀ ਕਿ ਉਹਦੇ 'ਚ ਇੱਕ ਹੀ ਗੱਲ ਨੂੰ ਬਹੁਤ ਹੀ ਜ਼ਿਆਦਾ ਲੰਬਾ ਖਿੱਚਿਆ ਗਿਆ ਬਾਕੀ ਉਸ ਵਿੱਚ ਜੋ ਵੀ ਗੱਲਾਂ ਕੀਤੀਆਂ ਗਈਆਂ ਮੈਨੂੰ ਵੀਡੀਓ ਕਾਲ 'ਚ ਉਸ ਕਾਨਫਰੰਸ 'ਚ ਬਹੁਤ ਆਨੰਦ ਆਇਆ ਅਤੇ ਬਹੁਤ ਕੁਛ ਸਿੱਖਣ ਨੂੰ ਮਿਲਿਆ